ਹਾਂਜੀ ਵੱਧਦੀ ਮਹਿੰਗਾਈ ਦੇ ਕਰਕੇ ਕਈ ਲੋਕ ਖੇਤੀਬਾੜੀ ਦੇ ਕੰਮ ਦੇ ਵਿੱਚ ਉਲਝਣ ਤੋਂ ਕਤਰਾਉਂਦੇ ਨੇ ਚਾਹੇ ਉਹਨਾਂ ਦੇ ਪਰਿਵਾਰ ਵੀ ਹਨ ਪਰ ਇੱਕ ਮਜ਼ਬੂਰੀ ਵੀ ਹੈ ਕੁਝ ਲੋਕਾਂ ਦੀ ਜਿਸ ਦੇ ਕਰਕੇ ਉਹ ਖੇਤੀਬਾੜੀ ਦੇ ਵਿੱਚ ਰੁਝਾਨ ਨਹੀਂ ਦੇ ਰਹੇ ਕਿਉਂਕਿ ਮਹਿੰਗਾਈ ਇੰਨੀ ਜ਼ਿਆਦਾ ਵੱਧ ਗਈ ਹੈ ਅਤੇ ਕੰਮ ਜ਼ਿਆਦਾ ਹੋਣ ਦੇ ਕਰਕੇ ਲੋਕਾਂ ਦਾ ਰੁਝਾਨ ਉਸ ਚੀਜ਼ ਦੇ ਵਿੱਚ ਘੱਟ ਰਿਹਾ ਹੈ ਕਿਉਂਕਿ ਕੁਝ ਲੋ ਕਿਉਂਕਿ ਜਿਹੜੀ ਨਵੀਂ ਪੀੜੀ ਆ ਰਹੀ ਹੈ ਨਵੇਂ ਬੱਚੇ ਆ ਰਹੇ ਹਨ ਉਹਨਾਂ ਦਾ ਰੁਝਾਨ ਜ਼ਿਆਦਾਤਰ ਬਾਹਰ ਜਾਣ ਦੇ ਵਿੱਚ ਹੈ ਫੋਰਨ ਕੰਟਰੀ ਦੇ ਵਿੱਚ ਕੈਨੇਡ ਕੈਨੇਡਾ ਦੇ ਵਿੱਚ ਅਮਰੀਕਾ ਅਸਟਰੇਲੀਆ ਇਹ ਜਗ੍ਹਾ ਜਾਂਦੇ ਨੇ ਜਿਨ੍ਹਾਂ ਦੇ ਕਰਕੇ ਜਿਹੜੇ ਅੱਜ ਕੱਲ੍ਹ ਦੇ ਬੱਚੇ ਨੇ ਉਹ ਸਾਰੇ ਬਾਹਰ ਜਾ ਰਹੇ ਨੇ ਅਤੇ ਖੇਤੀਬਾੜੀ ਦੇ ਵਿੱਚੋਂ ਉਹ ਕਿੱਤੇ ਦੇ ਵਿੱਚੋਂ ਹੱਥ ਛੁਡਵਾ ਰਹੇ ਹਨ ਅਤੇ ਪੁਰਾਣੇ ਜਿਹੜੇ ਮਾਂ ਬਾਪ ਹਨ ਉਹਨਾਂ ਦੇ ਵਿੱਚ ਵੀ ਹੁਣ ਉਹ ਸਿਆਣੇ ਹੋ ਗਏ ਜਿਨ੍ਹਾਂ ਦੇ ਕਰਕੇ ਉਹਨਾਂ ਤੋਂ ਖੇਤੀਬਾੜੀ ਨਹੀਂ ਹੁੰਦੀ ਹੈ ਜਿਨ੍ਹਾਂ ਦੇ ਕਰਕੇ ਉਸ ਚੀਜ਼ ਦੇ ਵਿੱਚ ਰੁਝਾਨ ਉਹਨਾਂ ਦਾ ਘੱਟ ਰਿਹਾ ਹੈ ਅਤੇ ਖੇਤੀਬਾੜੀ ਦੀ ਮਹੱਤਤਾ ਬਹੁਤ ਵੱਡੀ ਹੈ ਜਿਸ ਦੇ ਕਰਕੇ ਪੰਜਾਬ ਅੱਜ ਕੱਲ੍ਹ ਸਟੇਟ ਦੇ ਘੱਟਦਾ ਜਾ ਰਿਹਾ ਹੈ ਕਿਉਂਕਿ ਹੋਰ ਸਟੇਟਾਂ ਦੇ ਵਿੱਚ ਵੀ ਗੇਂਹੂ ਅਤੇ ਚਾਵਲ ਜ਼ਿਆਦਾ ਮਾਤਰਾ ਦੇ ਵਿੱਚ ਉਗਾਏ ਜਾਂਦੇ ਨੇ ਜਿਸਦੇ ਕਰਕੇ ਅੱਜ ਕੱਲ੍ਹ ਪੰਜਾਬ ਦੇ ਵਿੱਚ ਇਸ ਚੀਜ਼ ਦੀ ਕਮੀ ਮਹਿਸੂਸ ਕੀਤੀ ਜਾਂਦੀ ਹੈ ਕਿਉਂਕਿ ਜ਼ਿਆਦਾਤਰ ਬੱਚੇ ਬਾਹਰ ਜਾਣ ਦੇ ਕਰਕੇ ਖੇਤੀਬਾੜੀ ਕਰਨ ਦੇ ਲਈ ਪਿੱਛੇ ਉਹਨਾਂ ਦੇ ਕੋਲ ਕੋਈ ਸਾਥੀ ਨਹੀਂ ਰਹਿੰਦਾ ਹੈ ਜਿਸਦੇ ਕਰਕੇ ਇਹ ਸਭ ਤੋਂ ਵੱਡੀ ਮੁਸ਼ਕਲ ਇਹ ਹੈ ਅਤੇ ਸਾਡੇ ਪੰਜਾਬ ਦੇ ਵਿੱਚ ਬਾਹਰ ਤੋਂ ਜ਼ਿਆਦਾ ਇੱਧਰ ਆਉਂਦੇ ਹਨ ਬਿਹਾਰ ਅਤੇ ਯੂਪੀ ਦੇ ਵਿੱਚੋਂ ਲੋਕ ਇੱਥੇ ਆ ਕੇ ਖੇਤੀ ਦੇ ਵਿੱਚ ਹੱਥ ਵਟਾਉਂਦੇ ਹਨ ਜੋ ਕਿ ਪੰਜਾਬ ਦੇ ਲਈ ਚੰਗੀ ਗੱਲ ਨਹੀਂ ਹੈ ਇਸ ਚੀਜ਼ ਨੂੰ ਰੋਕਿਆ ਜਾਣਾ ਚਾਹੀਦਾ ਹੈ ਅਤੇ ਪੰਜਾਬ ਦੇ ਬੱਚਿਆਂ ਨੂੰ ਪੰਜਾਬ ਦੇ ਵਿੱਚ ਹੀ ਰਹਿ ਕੇ ਖੇਤੀ ਕਰਨੀ ਚਾਹੀਦੀ ਹੈ ਜਿਸ ਦੇ ਕਾਰਨ ਖੇਤੀ ਦੇ ਵਿੱਚੋਂ ਚੰਗਾ ਮੁਨਾਫਾ ਅਤੇ ਪਰਿਵਾਰ ਖੁਸ਼ਹਾਲ ਰਹੇ ਜਿਸਦੇ ਕਰਕੇ ਪੰਜਾਬ ਦੀ ਇੱਕ ਅਲੱਗ ਤੋਂ ਪਛਾਣ ਬਣੀ ਰਹੇ